ਮੈਂ ਤੁਹਾਡੇ ਨਾਲ਼ ਆਪਣੀ ਸਕੂਲ ਟਾਈਮ ਦੀ ਗੱਲ ਸਾਂਝੀ ਕਰਨੀ ਚਾਹਾਂਗੀ ਸਕੂਲ ਸਮੇਂ ਵਿੱਚ ਸਾਡੀ ਜਮਾਤ ਦੀ ਇੱਕ ਕੁੜੀ ਬਹੁਤ ਚਲਾਕ ਸੀ ਉਹ ਸਾਰਾ ਦਿਨ ਛੋਟੇ ਬੱਚਿਆਂ ਨੂੰ ਤੰਗ ਕਰਦੀ ਰਹਿੰਦੀ ਸੀ ਉਹ ਜਮਾਤ ਦੇ ਵਿਦਿਆਰਥੀਆਂ ਦੇ ਬਸਤੇ 'ਚੋਂ ਟਿਫਨ ਕੱਢ ਕੇ ਖਾ ਜਾਂਦੀ ਸੀ ਪ੍ਰਿੰਸੀਪਲ ਨੇ ਕਈ ਵਾਰ ਉਸਨੂੰ ਵਰਜਿਆ ਅਤੇ ਉਸਦੇ ਘਰ ਵੀ ਸ਼ਿਕਾਇਤ ਕੀਤੀ ਜਦੋਂ ਅਸੀਂ ਪਾਸ ਹੋ ਕੇ ਅਗਲੀ ਪੜ੍ਹਾਈ ਲਈ ਕਾਲਜ ਚਲੇ ਗਏ ਫਿਰ ਉਹ ਸਾਨੂੰ ਕਦੇ ਨਹੀਂ ਮਿਲੀ